ਉਂਝ ਤਾਂ ਮੈਂ ਬਹੁਤ ਹੀ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਪਰ ਇੱਕ ਕਿਤਾਬ ਜਿਸ ਨੇ ਮੇਰੀ ਜ਼ਿੰਦਗੀ ਉੱਤੇ ਬਹੁਤ ਹੀ ਅਸਰ ਪਾਇਆ ਅਤੇ ਜਿਸਨੇ ਮੇਰੀ ਮੈਨੂੰ ਬਹੁਤ ਹੀ ਭਾਵੁਕ ਕਰ ਦਿੱਤਾ ਉਹ ਇਹ ਸੀ ਉਸ ਕਿਤਾਬ ਦਾ ਨਾਮ ਦੋ ਭਿਖਾਰੀ ਸੀ ਜਿਸ ਵਿੱਚ ਭਿਖਾਰੀ ਦੇ ਜੀਵਨ ਬਾਰੇ ਗੱਲ ਕੀਤੀ ਗਈ ਸੀ ਇਸ ਵਿੱਚ ਭਿਖਾਰੀ ਦੇ ਜੀਵਨ ਨੂੰ ਬਹੁਤ ਹੀ ਸਜੀਵ ਰੂਪ ਨਾਲ ਪੇਸ਼ ਕੀਤਾ ਗਿਆ ਸੀ ਇਸਦਾ ਇੱਕ ਦ੍ਰਿਸ਼ ਜੋ ਕਿ ਮੈਨੂੰ ਯਾਦ ਹੈ ਉਹ ਇਹ ਸੀ ਕਿ ਜਦੋਂ ਇੱਕ ਭਿਖਾਰੀ ਆਪਣੇ ਦੋ ਬੱਚਿਆਂ ਨਾਲ ਸੜਕ ਉੱਤੇ ਜਾ ਰਿਹਾ ਹੁੰਦਾ ਹੈ ਤਾਂ ਉਹ ਬੱਚੇ ਆਪਣੇ ਪੇਟ ਨੂੰ ਪੇਟ ਉੱਤੇ ਹੱਥ ਫੈਲਾਉਂਦੇ ਹੋਏ ਆਪਣੇ ਪੇਂਟ ਉੱਤੇ ਹੱਥ ਮਾਰਦੇ ਹੋਏ ਲੋਕਾਂ ਤੋਂ ਭੀਖ ਮੰਗਦੇ ਹਨ ਅਤੇ ਜਦੋਂ ਉਹਨਾਂ ਨੂੰ ਸੜਕ ਦੇ ਕਿਨਾਰੇ ਕੁਝ ਰੋਟੀ ਦੇ ਟੁੱਕੜੇ ਮਿਲਦੇ ਹਨ ਅਤੇ ਜਦੋਂ ਉਹ ਉਹਨਾਂ ਨੂੰ ਚੱਕਣ ਜਾਂਦੇ ਹਨ ਤਾਂ ਉਹ ਰੋਟੀ ਦੇ ਟੁੱਕੜੇ ਵੀ ਕੁੱਤੇ ਛੀਨ ਲੈਂਦੇ ਹਨ ਅਤੇ ਉਹ ਫਿਰ ਵੀ ਭੁੱਖੇ ਹੀ ਰਹਿ ਜਾਂਦੇ ਹਨ ਇਸ ਦਾ ਇੱਕ ਵਾਕ ਜੋ ਕਿ ਮੈਨੂੰ ਯਾਦ ਹੈ ਇਸ ਵਿੱਚ ਉਹ ਇਹ ਸੀ ਕਿ ਉਹਨਾਂ ਭਿਖਾਰੀ ਦੇ ਬੱਚਿਆਂ ਦਾ ਪੇਟ ਅਤੇ ਪਿੱਠ ਇੱਕ ਹੀ ਹੋ ਚੁੱਕੇ ਸੀ ਮਤਲਬ ਉਹ ਇੰਨੇ ਜ਼ਿਆਦਾ ਕਮਜ਼ੋਰ ਹੋ ਚੁੱਕੇ ਸਨ ਕਿ ਉਹਨਾਂ ਦਾ ਪੇਟ ਪੇਟ ਅਤੇ ਪਿੱਠ ਇੱਕ ਹੀ ਲੱਗਦੀ ਸੀ ਅਤੇ ਉਹ ਆਪਣੀ ਇਸ ਆਰਥਿਕ ਤੰਗੀ ਤੋਂ ਬਹੁਤ ਹੀ ਪਰੇਸ਼ਾਨ ਸਨ